ਮੀਡੀਆ ਜਿਵੇਂ ਕਿ ਸਾਡੇ ਦੂਰਦਰਸ਼ਨ ਜਲੰਧਰ ਤੋਂ ਪੰਜਾਬੀ ਰੰਗਮੰਚ ਦੇ ਪ੍ਰੋਗਰਾਮ ਜੋ ਹਰੇਕ ਐਤਵਾਰ ਦਿਖਾਏ ਜਾਂਦੇ ਹਨ ਉਹਨਾਂ ਦੇ ਪੰਜਾਬ ਦੀਆਂ ਗਤੀਵਿਧੀਆ ਦੇ ਵਿੱਚ ਬਹੁਤ ਅਹਿਮ ਰੋਲ ਅਦਾ ਕੀਤੇ ਗਏ ਹਨ ਟੈਲੀਵਿਜ਼ਨ ਜੋ ਕਿ ਇੱਕ ਪੰਜਾਬੀ ਅੰਗਰੇਜ਼ੀ ਹਿੰਦੀ ਭਾਸ਼ਾਵਾਂ ਦੇ ਅਨੁਵਾਦ ਦਾ ਇੱਕ ਬਹੁਤ ਵਧੀਆ ਤਰੀਕਾ ਹੈ ਜਿਸ ਦੇ ਵਿੱਚ ਤਸਵੀਰਕਾਰੀਆਂ ਅਤੇ ਆਵਾਜ਼ਾਂ ਦੇ ਮਾਧਿਅਮ ਰਾਹੀਂ ਲੋਕਾਂ ਤੱਕ ਬਹੁਤ ਵਧੀਆ ਸਨੇਹੇ ਗੀਤਕਾਰੀਆਂ ਅਦਾਕਾਰੀਆਂ ਪੇਸ਼ ਕੀਤੀਆਂ ਜਾਂਦੀਆਂ ਹਨ ਜਿਹਨਾਂ ਨੂੰ ਸਾਰੇ ਹੀ ਪੱਧਰ ਦੀਆਂ ਭਾਸ਼ਵਾਂ ਦੇ ਰਾਹੀਂ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ ਪ੍ਰਿੰਟ ਦੀ ਗੱਲ ਆਪਾਂ ਕਰੀਏ ਤਾਂ ਪ੍ਰਿੰਟ ਦੇ ਰਾਹੀਂ ਕਾਗਜ਼ੀ ਵਰਤੋਂ ਕਿਤਾਬੀ ਗਿਆਨ ਸਾਡੇ ਬੱਚਿਆਂ ਤੱਕ ਸਾਡੇ ਬਜ਼ੁਰਗਾਂ ਮਾਤਾਵਾਂ ਤੱਕ ਸਾਰਿਆਂ ਤੱਕ ਅਖਬਾਰ ਆਦਿ ਦੀਆਂ ਵਿਧੀਆਂ ਜੋ ਕਾਗਜ਼ ਦੀ ਛਾਪੇਖਾਨੇ ਰਾਹੀਂ ਪਹੁੰਚਦੀਆਂ ਹਨ ਉਹਨਾਂ ਦਾ ਸਾਡੇ ਰੋਜ਼ਮੱਰਾ ਦੀ ਜ਼ਿੰਦਗੀ ਦੇ ਵਿੱਚ ਅਹਿਮ ਰੋਲ ਹੈ ਜਿਸ ਦੀ ਵਰਤੋਂ ਨਾਲ ਹੀ ਅਸੀਂ ਅਗਿਆਨਤਾ ਨੂੰ ਦੂਰ ਕਰਦੇ ਹਾਂ ਪ੍ਰਿੰਟਿੰਗ ਪ੍ਰੈਸਾਂ ਦਾ ਵੀ ਬਹੁਤ ਵਧੀਆ ਰੋਲ ਹੈ ਪੰਜਾਬ ਦੀਆਂ ਨੌਜਵਾਨੀ ਬਜ਼ੁਰਗੀ ਅਤੇ ਬੱਚਿਆਂ ਦੇ ਨਵੇਕਲੇ ਭਵਿੱਖ ਦੇ ਲਈ ਅਸੀਂ ਜੋ ਵੀ ਕਾਰਗੁਜ਼ਾਰ ਹਾਂ ਉਹ ਪ੍ਰਿੰਟਿੰਗ ਪ੍ਰੈਸ ਦੇ ਟੈਲੀਵਿਜ਼ਨ ਮੀਡੀਆ ਦੇ ਬਹੁਤ ਧੰਨਵਾਦੀ ਹਾਂ